ਪੰਜਾਬ ਵਿੱਚ ਸਿਹਤ ਸੰਭਾਲ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਵੀ ਨਹੀਂ ਹੈ ਅਤੇ ਬਹੁਤ ਜ਼ਿਆਦਾ ਚੰਗੀ ਵੀ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਇੱਕ ਇਹੋ ਜਿਹਾ ਇਲਾਕਾ ਹੈ ਜਿਹਦੇ ਵਿੱਚ ਬ ਅਮੀਰ ਵੀ ਬਹੁਤ ਹਨ ਅਤੇ ਗਰੀਬ ਵੀ ਬਹੁਤ ਹਨ ਅਤੇ ਇਹਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਇੱਥੇ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਜੇ ਅਸੀਂ ਕਹੀਏ ਕਿ ਜਦੋਂ ਬਹੁਤ ਜ਼ਿਆਦਾ ਅ ਫੋਰਨ ਦੇ ਨਾਲ ਰਿਲੇਟਡ ਕਰੀ ਮਿਲਾਈਏ ਤਾਂ ਉਹ ਓਨੀ ਕੁ ਜ਼ਿਆਦਾ ਤਾਂ ਨਹੀਂ ਹੈਗੀ ਆ ਸਥਿਤੀ ਬਹੁਤ ਜ਼ਿਆਦਾ ਚੰਗੀ ਵੀ ਹੈ ਅਤੇ ਬਹੁਤ ਜ਼ਿਆਦਾ ਮਾੜੀ ਵੀ ਹੈ ਇਸ ਵਿੱਚ ਅਸੀਂ ਆਪਣੇ ਇਲਾਕੇ ਵਿੱਚ ਲੋ ਜਿਹੜੇ ਗਰੀਬ ਲੋਕ ਹੁੰਦੇ ਹਨ ਇੱਕ ਤਾਂ ਉਹ ਸਰਕਾਰੀ ਹਸਪਤਾਲਾਂ ਵਿੱਚ ਤੁਹਾਨੂੰ ਬ ਇਲਾਜ ਵੀ ਇੱਕ ਮੁਫ਼ਤ ਦਾ ਇਲਾਜ ਹੁੰਦਾ ਹੈ

ਇਸ ਤਰ੍ਹਾਂ ਕਈ ਵਾਰ ਅਸੀਂ ਨੇੜਲੇ ਕਿਸੇ ਹੋਰ ਵੀ ਬੰਦੇ ਕੋ ਪੁੱਛ ਲਈਏ ਤਾਂ ਪੰਜਾਬ ਦੇ ਲੋਕ ਬੜੇ ਹੀ ਮਦਦਗਾਰ ਹਨ ਅਤੇ ਉਹ ਹਰ ਇੱਕ ਦੂਸਰੇ ਦੀ ਮਦਦ ਕਰਨ ਦੀ ਹਰ ਵੇਲੇ ਤਿਆਰ ਰਹਿੰਦੇ ਹਨ ਇਸ ਕਰਕੇ ਜੇ ਅਸੀਂ ਇਹਨਾਂ ਰਾ ਲੋਕਾਂ ਕੋਲੋਂ ਵੀ ਪੁੱਛ ਲੈਂਦੇ ਹਨ ਕਿ ਕਿਤੇ ਸਾਨੂੰ ਸਰਕਾਰੀ ਹਸਪ ਬ ਗਰੀਬ ਬੰਦਾ ਪੁੱਛ ਲੈਂਦਾ ਹੈ ਤਾਂ ਉਹ ਬੜੇ ਹੀ ਆਰਾਮ ਨਾਲ ਦੱਸ ਦਿੰਦੇ ਹਨ